ਮੋਹਾਲੀ ਜ਼ਿਲ੍ਹੇ ਵਿੱਚ ਕੁਝ ਆਮ ਸਮਾਜਿਕ ਸੱਭਿਆਚਾਰਕ ਰੀਤੀ ਰਿਵਾਜ ਇਸ ਪ੍ਰਕਾਰ ਹਨ ਜਿਵੇਂ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਤਾਂ ਪਹਿਲਾਂ ਬੱਚੇ ਦਾ ਜਨਮ ਹੁੰਦਾ ਹੈ ਅਤੇ ਜਨਮ ਨਾਲ਼ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ ਹਨ ਜਿਵੇਂ ਕਿ ਬੱਚੇ ਦਾ ਨਾਮ ਰੱਖਣਾ ਉਹਦਾ ਪਹਿਲਾ ਅਕਸ਼ਰ ਗੁਰਦੁਆਰੇ ਤੋਂ ਕਢਵਾਉਣਾ ਅਤੇ ਉਸ ਤੋਂ ਬਾਅਦ ਬੱਚੇ ਨੂੰ ਗੁੜਤੀ ਦਵਾਉਣੀ ਅਤੇ ਉਸ ਤੋਂ ਬਾਅਦ ਉਸ ਦੀ ਲੋਹੜੀ ਵੰਡਣੀ ਇਹ ਸਾਰੇ ਹੀ ਇੱਕ ਰੀਤੀ ਰਿਵਾਜ ਦਾ ਹਿੱਸਾ ਹਨ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਵਿਆਹ ਦੀ ਵਿਆਹ ਦੇ ਨਾਲ਼ ਸੰਬੰਧਿਤ ਵੀ ਬਹੁਤ ਸਾਰੇ ਰੀਤੀ ਰਿਵਾਜ ਹਨ ਜਿਵੇਂ ਮੁੰਡੇ ਦੇ ਵਿਆਹ ਤੋਂ ਪਹਿਲਾਂ ਘੋੜੀਆਂ ਗਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਘਰ ਹੀ ਮਠਿਆਈਆਂ ਬਣਾਉਣੀਆਂ ਸਾਰਾ ਕੁਛ ਰੀਤੀ ਰਿਵਾਜਾਂ ਦੇ ਅੰਦਰ ਹੀ ਆਉਂਦਾ ਏ ਅਤੇ ਉਸ ਤੋਂ ਬਾਅਦ ਜਿਵੇਂ ਕੋਈ ਸੋਗ ਦੀ ਘੜੀ ਹੁੰਦੀ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਦੇ ਨਾਲ਼ ਸੰਬੰਧਿਤ ਕੁਝ ਅਲੱਗ ਰੀਤੀ ਰਿਵਾਜ ਹੁੰਦੇ ਹਨ ਜਿਵੇਂ ਮੌਤ ਤੋਂ ਬਾਅਦ ਜੋ ਘਰ ਦਾ ਬੜਾ ਬੇਟਾ ਹੁੰਦਾ ਉੱਥੇ ਪੱਗੜੀ ਦੀ ਰਸਮ ਕੀਤੀ ਜਾਂਦੀ ਹੈ ਇਹ ਸਾਰੇ ਰੀਤੀ ਰਿਵਾਜਾਂ ਦੇ ਅੰਦਰ ਆਉਂਦੇ ਹਨ ਰੀਤੀ ਰਿਵਾਜਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਰੀਤੀ ਰਿਵਾਜ ਹੀ ਸਾਨੂੰ ਦੱਸਦੇ ਹਨ ਕਿ ਅਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਏ ਅਤੇ ਕਿਵੇਂ ਸਮਾਜ ਦੇ ਵਿੱਚ ਰਹਿਣਾ ਏ ਇਹ ਸਾਰੇ ਸਾਨੂੰ ਰੀਤੀ ਰਿਵਾਜ ਹੀ ਸਿਖਾਉਂਦੇ ਹਨ